ਪੰਜਾਬ ਵਿੱਚ ਜਿਸ ਤਰ੍ਹਾਂ ਵੱਖ ਵੱਖ ਧਰਮ ਦੇ ਧਰਮਾਂ ਦੇ ਲੋਕ ਰਹਿੰਦੇ ਹਨ ਉੇਸੇ ਤਰ੍ਹਾਂ ਦੇ ਉਨ੍ਹਾਂ ਦੇ ਹਿਸਾਬ ਦੇ ਨਾਲ ਉਨ੍ਹਾਂ ਦੇ ਤਿਉਹਾਰ ਹਨ ਲੇਕਿਨ ਹਰ ਤਿਉਹਾਰ ਦੇ ਵਿੱਚ ਹਰ ਧਰਮ ਦਾ ਬੰਦਾ ਉਸ ਦੇ ਵਿੱਚ ਪਾਰਟੀਸਪੇਟ ਕਰਦਾ ਉਹਦੇ ਵਿੱਚ ਜਾਂਦਾ ਨਤਮਸਤਕ ਹੁੰਦਾ ਜਿਸ ਤਰ੍ਹਾਂ ਅਸੀਂ ਨਗਰ ਕੀਰਤਨ ਦੀ ਗੁਰਪੂਰਬ ਦੀ ਗੱਲ ਕਰੀਏ ਅਤੇ ਉਹਦੇ ਵਿੱਚ ਸਿੱਖ ਤੋਂ ਲੈ ਕੇ ਹਿੰਦੂ ਮੁਸਲਮਾਨ ਸਾਰੇ ਹੀ ਆਉਂਦੇ ਹਨ ਜਿਸ ਤਰ੍ਹਾਂ ਅਸੀਂ ਦਰਬਾਰ ਸਾਹਿਬ ਦੇ ਨਵੇਂ ਸਾਲ ਦੀ ਗੱਲ ਕਰੀਏ ਹਰ ਧਰਮ ਦਾ ਬੰਦਾ ਉੱਥੇ ਆ ਕੇ ਮੱਥਾ ਟੇਕਦਾ ਹੈ ਅਤੇ ਆਏ ਆਪਣੇ ਨਵੇਂ ਸਾਲ ਨੂੰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹਿੰਦੂਆਂ ਦਾ ਕ੍ਰਿਸ਼ਨ ਜੀ ਦਾ ਜਨਮ ਜਨਮ ਅਸ਼ਟਮੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਵਿੱਚ ਵੀ ਹਰ ਧਰਮ ਦਾ ਬੰਦਾ ਜਾ ਕੇ ਆਪਣਾ ਪਾਰਟੀਸਪੇਟ ਕਰਦਾ ਹੈ ਅਤੇ ਆਪਣੇ ਹਿਸਾਬ ਦੇ ਨਾਲ ਉਸ ਧਰਮ ਦੀ ਵਿਸ਼ੇਸ਼ਤਾ ਕਰਦਾ ਹੈ ਧੰਨਵਾਦ